ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਿੰਦਰ ਗੱਲ ਕਰ ਰਹੀ ਹਾਂ ਅਤੇ ਮੈਂ ਇੱਥੇ ਫਤਿਹਗੜ੍ਹ ਸਾਹਿਬ ਹੁਣੀ ਇੱਥੇ ਆਈ ਹਾਂ ਰਹਿਣ ਲਈ ਮੇਰੀ ਇੱਥੇ ਜੋਬ ਲੱਗੀ ਆ ਕੀ ਤੁਸੀਂ ਮੈਨੂੰ ਫਤਿਹਗੜ੍ਹ ਸਾਹਿਬ ਦੇ ਬਾਰੇ ਦੱਸ ਸਕਦੇ ਹੋ ਕਿ ਇੱਥੋਂ ਦਾ ਇਤਿਹਾਸ ਕੀ ਹੈ ਸਰ ਇੱਥੇ ਕੋਈ ਹੋਰ ਵੀ ਇੱਦਾਂ ਦੇ ਇਤਿਹਾਸਿਕ ਗੁਰਦੁਆਰੇ ਨੇ ਜਿਨ੍ਹਾਂ ਨਾਲ ਜਿੱਥੇ ਅਸੀਂ ਜਾ ਕੇ ਹੋਰ ਵੀ ਜ਼ਿਆਦਾ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ ਓਕੇ ਠੀਕ ਹੈ ਸਰ ਮੈਂ ਇਸ ਤੋਂ ਪਹਿਲਾਂ ਇੱਕ ਆਮ ਖਾਸ ਬਾਗ ਬਾਰੇ ਵੀ ਸੁਣਿਆ ਸੀਗਾ ਜਿਹੜਾ ਕਿ ਇੱਥੇ ਬਣਵਾਇਆ ਗਿਆ ਸੀਗਾ ਤਾਂ ਤੁਸੀਂ ਮੈਨੂੰ ਉਹਦੇ ਬਾਰੇ ਦੱਸ ਸਕਦੇ ਹੋ ਕੁਛ ਠੀਕ ਹੈ ਸਰ ਅਤੇ ਸਰ ਅਗਰ ਮੈਂ ਇੱਦਾਂ ਕਹਾਂ ਕਿ ਜਿੱਥੇ ਮੈਂ ਹੁਣ ਮਤਲਬ ਸਾਡੀ ਜਗ੍ਹਾ ਜਿੱਥੇ ਮੇਰਾ ਘਰ ਹੈ ਉੱਥੇ ਤੋਂ ਮੇਰਾ ਜਿਹੜਾ ਜਿੱਥੇ ਮੈਂ ਜੋਬ ਕਰਦੀ ਉਹਦਾ ਡਿਸਟੈਂਸ ਦੋ ਤੋਂ ਤਿੰਨ ਕਿਲੋਮੀਟਰ ਹੈਗਾ ਆ ਕੀ ਉੱਥੇ ਕੋਈ ਇੱਦਾਂ ਦਾ ਟਰੈਵਲ ਕਰਨ ਵਾਸਤੇ ਕੁਛ ਹੈ ਵੀ ਆਪਾਂ ਕਿੱਦਾਂ ਟਰੈਵਲ ਕਰ ਸਕਦੇ ਹਾਂ ਓਕੇ ਸਰ ਥੈਂਕ ਯੂ ਸੋ ਮਚ ਸਰ ਤੁਸੀਂ ਮੇਰੇ ਨਾਲ ਐਨੀ ਜਾਣਕਾਰੀ ਸ਼ੇਅਰ ਕੀਤੀ ਥੈਂਕ ਯੂ ਸਰ